ਪਾਣੀ ਨੂੰ ਫਿਲਟਰ ਕਰਨ ਲਈ ਅਸੀਂ ਆਪਣੇ ਘਰ ਕੈਂਟ ਦਾ ਆਰ ਓ ਲਗਾਇਆ ਹੋਇਆ ਹੈ ਪਰ ਜਿਸ ਤਰ੍ਹਾਂ ਹੁਣ ਕਹਿੰਦੇ ਕਿ ਜੇ ਤੁਸੀਂ ਆਰ ਓ ਦਾ ਪੂਰਾ ਪਾਣੀ ਉਸੇ ਤਰ੍ਹਾਂ ਹੀ ਪੀਂਦੇ ਹੋ ਤਾਂ ਉਹ ਆਪਣੀ ਸਿਹਤ ਲਈ ਚੰਗਾ ਨਹੀਂ ਹੁੰਦਾ ਉਹ ਆਪਣੇ ਸਰੀਰ ਦੇ ਵਿੱਚ ਤੇਜ਼ਾਬ ਪੈਦਾ ਕਰਦਾ ਇਸ ਲਈ ਕੀ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਆਰ ਓ ਤੋਂ ਤੁਸੀਂ ਪਾਣੀ ਇਕੱਠਾ ਕਰ ਲਿਆ ਉਹਨੂੰ ਇੱਕ ਘੜੇ ਦੇ ਵਿੱਚ ਇਕੱਠਾ ਕਰ ਲਉ ਘੜੇ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਆਰ ਓ ਦਾ ਪੂਰਾ ਪਾਣੀ ਘੜੇ ਦੇ ਵਿੱਚ ਪਾ ਲੈਂਦੇ ਹਾਂ ਸਾਰੀ ਰਾਤ ਉਹ ਪਾਣੀ ਘੜੇ ਦੇ ਵਿੱਚ ਰਹਿੰਦਾ ਅਤੇ ਅਗਲੇ ਦਿਨ ਆਪਾਂ ਇਸ ਨੂੰ ਵਰਤ ਸਕਦੇ ਹਾਂ ਜਦੋਂ ਅਗਲੇ ਦਿਨ ਵਰਤਦੇ ਹਾਂ ਇੱਕ ਤਾਂ ਉਹ ਪਾਣੀ ਵਧੀਆ ਠੰਡਾ ਹੋ ਜਾਂਦਾ ਇੱਕ ਉਹਦੀ ਤਾਸੀਰ ਵੀ ਠੰਡੀ ਹੁੰਦੀ ਹੈ ਅਤੇ ਉਹ ਸਿਹਤ ਨੂੰ ਵੀ ਕੋਈ ਨੁਕਸਾਨ ਨਹੀਂ ਕਰਦਾ ਜੇ ਆਪਾਂ ਪਾਣੀ ਫਰਿੱਜ ਦੇ ਵਿੱਚ ਰੱਖਦੇ ਹਾਂ ਬੋਤਲਾਂ ਦੇ ਵਿੱਚ ਬੰਦ ਕਰਕੇ ਉਹ ਆਪਣੀ ਸਿਹਤ ਨੂੰ ਖਰਾਬ ਕਰਦਾ ਘੜੇ ਦੇ ਪਾਣੀ ਦੇ ਵਿੱਚ ਕੋਈ ਬਰਫ ਆਦਿ ਪਾਉਣ ਦੀ ਲੋੜ ਨਹੀਂ ਹੁੰਦੀ ਅਤੇ ਬਹੁਤ ਹੀ ਸਵਾਦ ਲੱਗਦਾ ਅਤੇ ਸਿਹਤ ਲਈ ਬਹੁਤ ਹੀ ਚੰਗਾ ਹੈ ਇਸ ਲਈ ਸਭ ਨੂੰ ਜਿਹੜੇ ਕੋਈ ਆਰ ਓ ਵਰਤਦੇ ਹਨ ਉਹਨਾਂ ਨੂੰ ਆਰ ਓ ਦਾ ਪਾਣੀ ਘੜੇ ਦੇ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ